ਸਾਡੇ ਖੇਤਰ ਵਿੱਚ ਜ਼ਿਆਦਾਤਰ ਕਬੱਡੀ ਜਾਂ ਹੋਕੀ ਦੀ ਗੇਮ ਖੇਡੀ ਜਾਂਦੀ ਹੈ ਜਦੋਂ ਕਿ ਬਾਹਰਲੇ ਛੇਤਰ੍ਹਾਂ ਵਿੱਚ ਹਾਕੀ ਅਤੇ ਕਬੱਡੀ ਦਾ ਬਹੁਤ ਰੁਝਾਨ ਨਹੀਂ ਹੈ ਕ੍ਰਿਕਟ ਤਾਂ ਸਾਰੇ ਭਾਰਤ ਵਿੱਚ ਖੇਡੀ ਜਾਂਦੀ ਹੈ ਔਰ ਬੈਡਮਿੰਟਨ ਬਾਸਕਟਬੋਲ ਵਗੈਰਾ ਵੀ ਬਾਹਰਲੇ ਸ ਸਾਈਡਾਂ 'ਤੇ ਬਹੁਤ ਖੇਡੀ ਜਾਂਦੀ ਹੈ ਪੰਜਾਬ ਦੇ ਵਿੱਚ ਸਾਡੇ ਬਹੁਤ ਘੱਟ ਹੈ ਔਰ ਇਸਨੂੰ ਵਧਾਉਣ ਲਈ ਵੀ ਗੌਰਮੈਂਟ ਦਾ ਬੜਾ ਹੱਥ ਹੈ ਔਰ ਪੰਜਾਬ ਦੀ ਸਰਕਾਰ ਇਹਦੇ ਵੱਲ ਬਹੁਤ ਧਿਆਨ ਦੇ ਰਹੀ ਹੈ ਤਾਂ ਕਿ ਦੇਸ਼ ਦੇ ਵਿੱਚ ਵੱਧ ਤੋਂ ਵੱਧ ਚੰਗੇ ਖਿਲਾੜੀ ਨਿਕਲਣ ਅਤੇ ਜ਼ਿਆਦਾ ਤੋਂ ਜ਼ਿਆਦਾ ਮੈਡਲ ਲੈ ਸਕਣ ਔਰ ਜਿਹੜੀਆਂ ਖੇਡਾਂ ਪੰਜਾਬ 'ਚ ਖੇਡੀਆਂ ਜਾਂਦੀਆਂ ਹਨ ਉਹ ਬਾਹਰ ਵੀ ਬਹੁਤ ਪਾਪੂਲਰ ਹੋ ਰਹੀਆਂ ਹਨ ਔਰ ਹੌਲੀ ਹੌਲੀ ਇਹ ਲੱਗਦਾ ਹੈ ਕਿ ਜਿਹੜੇ ਵੀ ਮੈਡਲ ਜ਼ਿਆਦਾਤਰ ਜਿਹੜੇ ਪੰਜਾਬੀ ਜਿੱਤਦੇ ਹਨ ਔਰ ਹਰਿਆਣਾ ਔਰ ਹਿਮਾਚਲ ਦੇ ਲੋਕ ਵੀ ਇਹਨਾਂ ਵਿੱਚ ਇੰਟਰਸਟ ਲੈਣ ਲੱਗ ਪਏ ਹਨ